ਵੈਸੇ ਤਾਂ ਸਮੇਂ ਦੇ ਹਿਸਾਬ ਨਾਲ ਪੰਜਾਬ ਵਿੱਚ ਕਾਫੀ ਸਿਆਸੀ ਪਾਰਟੀਆਂ ਨੇ ਰਾਜ ਕੀਤਾ ਅਤੇ ਹੋਰ ਇਹਨਾਂ ਦੇ ਵਿੱਚੋਂ ਹੈ ਕੋਂਗਰੈਸ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਦਲ ਅਤੇ ਕੋਂਗਰੈਸ ਦੇ ਜਿਹੜੇ ਮਸ਼ਹੂਰ ਲੀਡਰ ਸੀ ਪਹਿਲੇ ਉਹ ਸੀ ਗਿਆਨੀ ਜੈਲ ਸਿੰਘ ਜਿਨ੍ਹਾਂ ਨੇ ਉੱਨੀ ਸੌ ਬਹੱਤਰ ਤੋਂ ਲੈ ਕੇ ਉੱਨੀ ਸੌ ਸਤੱਤਰ ਤੱਕ ਰਾਜ ਕੀਤਾ ਅਤੇ ਇਹਨਾਂ ਤੋਂ ਬਾਅਦ ਵੀ ਕਾਫੀ ਆਏ ਸੀ ਅਤੇ ਹੁਣ ਪ੍ਰੈਜੈਂਟ ਵਿੱਚ ਹੈਗੇ ਆ ਸੋਨੀਆ ਗਾਂਧੀ ਜਿਹੜੇ ਕਿ ਕੋਂਗਰੈਸ ਦੀ ਵਾਂਗਡੋਰ ਸੰਭਾਲ ਰਹੇ ਆ ਅਤੇ ਇਸ ਤੋਂ ਬਾਅਦ ਹੈਗੀ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਲੀਡਰ ਹੈੱਡ ਵਜੋਂ ਕਿਰਦਾਰ ਨਿਭਾ ਰਿਹਾ ਉਹ ਆ ਅ ਅਰਵਿੰਦ ਕੇਜਰੀਵਾਲ ਅਤੇ ਜਿਹੜੇ ਕਿ ਇਸ ਸਮੇਂ ਦਿੱਲੀ ਦੇ ਚੀਫ ਮਨਿਸਟਰ ਨੇ ਅਤੇ ਕੇਜਰੀਵਾਲ ਨੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਸ਼ਿਸ਼ ਘੋਸ਼ਿਤ ਕੀਤਾ ਹੋਇਆ ਵਾ ਅਤੇ ਸ਼੍ਰੋਮਣੀ ਅਕਾਲੀ ਦਲ ਜਿਹਦੀ ਕਿ ਵਾਂਗਡੋਰ ਕਾਫੀ ਸਮੇਂ ਤੋਂ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸੰਭਾਲੀ ਸੀ ਜੋ ਕਿ ਹੁਣ ਸਾਡੇ ਵਿੱਚ ਮੌਜੂਦ ਨਹੀਂ ਹਨ ਅਤੇ ਹੁਣ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਇਹਨਾਂ ਦਾ ਜਿਹੜਾ ਬੇਟਾ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਆਪਣੀ ਪਿਤਾ ਜੀ ਦੀ ਪਾਰਟੀ ਨੂੰ ਸੰਭਾਲ ਰਿਹਾ ਹੈਗਾ ਵਾ ਅਤੇ ਯੋਗਦਾਨ ਪਾ ਰਿਹਾ ਹੈਗਾ ਆਪਣੀ ਪਿਤਾ ਜੀ ਦੀ ਪਾਰਟੀ ਨੂੰ ਸੰਭਾਲਣ 'ਚ